ਪਹਿਲਾਂ ਦੇ ਸਮੇਂ ਤੋਂ ਇਸ ਸਮੇਂ ਤੱਕ ਦੁਨੀਆਂ ਵਿੱਚ ਬਹੁਤ ਹੀ ਸਾਰੇ ਚੇਂਜ ਆਏ ਹਨ ਜਿਸ ਵਿੱਚ ਇਲੈਕਟ੍ਰੋਨਿਕ ਆਉਣ ਜਾਣ ਦਾ ਆਉਣ ਜਾਣ ਲਈ ਬੱਸਾਂ ਕਾਰਾਂ ਆਦਿ ਜਹਾਜ਼ ਅਤੇ ਹੋਰ ਸਹੂਲਤਾਂ ਜਿਵੇਂ ਕਿ ਬੈਂਕਾਂ ਇੰਟਰਨੈੱਟ ਅਤੇ ਹੋਰ ਸੰਚਾਰਿਤ ਸਾਧਨ ਜਿਵੇਂ ਕਿ ਸੰਸਾਰ ਭਰ ਦੀਆਂ ਖਬਰਾਂ ਅਸੀਂ ਇੰਟਰਨੈੱਟ ਰਾਹੀਂ ਦੇਖ ਸਕਦੇ ਹਾਂ ਅਤੇ ਹੋਰ ਵੀ ਬਹੁਤ ਕੁਛ ਮਤਲਬ ਜੋਬਸ ਵਗੈਰਾ ਹੋਰ ਕਾਫੀ ਕੁਛ ਇੰਟਰਨੈੱਟ ਰਾਹੀਂ ਅਸੀਂ ਕਰ ਸਕਦੇ ਹਾਂ